ਹਾਂਜੀ ਮੈਂ ਬਚਪਨ ਤੁਸੀਂ ਆਪਣਾ ਸਕੂਲ 'ਚ ਜਾਨੀ ਕਿ ਭੰਗੜੇ ਦੇ ਨਾਲ ਆਪਣਾ ਕਾਫੀ ਮੈਨੂੰ ਪੰਜਾਬੀ ਕਲਚਰ ਨਾਲ ਪਿਆਰ ਆ ਆਪਣਾ ਅਤੇ ਕਾਫੀ ਸਮੇਂ ਤੋਂ ਮੈਂ ਆਪਣੇ ਨਾਲ ਵੀ ਮੈਂ ਕਲਾਸ ਫੈਲੋ ਕਲਾਸ 'ਚ ਸਾਨੂੰ ਭੰਗੜੇ ਭੁੰਗੜੇ ਦਾ ਸਭ ਕੁਝ ਸਿਖਾਇਆ ਜਾਂਦਾ ਸੀਗਾ ਅਤੇ ਉਹਦੇ ਨਾਲ ਯੋਗਾ ਕਾਫੀ ਯਾਨੀ ਕਿ ਅਸੀਂ ਸ਼ੁਰੂ ਤੋਂ ਹੀ ਐਕਟੀਵੇਟ ਰਹੇ ਹਾਂ ਭੰਗੜਾ ਦਾ ਬਹੁਤ ਵਧੀਆ ਚੀਜ਼ ਆ ਕੋਈ ਕਰੇ ਚਾਹੇ ਨਾ ਕਰੇ ਪਰ ਮੈਂ ਤਾਂ ਇਸ ਚੀਜ਼ ਨੂੰ ਸਭ ਨੂੰ ਕਹਿਣਾ ਚਾਹੁੰਦਾ ਕਿ ਭੰਗੜੇ ਕਰਕੇ ਐਕਸਸਾਈਜ ਹੁੰਦੀ ਰਹਿੰਦੀ ਹੈ ਭੰਗੜਾ ਬਹੁਤ ਵਧੀਆ ਚੀਜ਼ ਆ ਕੋਈ ਉਹ ਨਹੀਂ ਹੈਗਾ ਇਹਦੇ 'ਚ ਅਤੇ ਆਪਾਂ ਤਾਂ ਆਹ ਹੀ ਕਹਿੰਦੇ ਆ ਜੀ ਜਿੰਨਾ ਆਪਣਾ ਸਰੀਰ ਚੱਲਦਾ ਰਹੇਗਾ ਉਨਾ ਸੁਸਤ ਦੇ ਤੰਦਰੁਸਤ ਰਹੇਗਾ ਸਰੀਰ ਆਪਣਾ ਸਭ ਨਾਲ ਬੈਟਰ ਹੈ ਕੋਈ ਉਹ ਨਹੀਂ ਹੈਗਾ ਬਟ ਸਭ ਮੈਂ ਤਾਂ ਇਹੀ ਕਹਿੰਦਾ ਵਾ ਕਿ ਸਭ ਨੂੰ ਆਪਣੇ ਯਾਦਗਾਰੀ ਰੱਖਣੀ ਹੈ ਕਿ ਆਪਣਾ ਯਾਦਗਾਰ ਰਹਿੰਦੀ ਆ ਵੈਸੇ ਬਚਪਨ 'ਚ ਕੀ ਕੀਤਾ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਐਕਟਿਵ ਹੋਇਆ ਇਹ ਬਹੁਤ ਵਧੀਆ ਹੈ